ਭੰਗੜਾ ਪੰਜਾਬੀ ਸੱਭਿਆਚਾਰ ਦਾ ਅਨਿਖੜ ਅੰਗ ਹੈ ਭੰਗੜਾ ਉਹ ਲੋਕ ਨਾਚ ਹੈ ਜੋ ਪੰਜਾਬ ਦੇ ਗੱਭਰੂਆਂ ਵੱਲੋਂ ਪਾਇਆ ਜਾਣ ਵਾਲਾ ਨਾਚ ਹੈ ਬੇਸ਼ੱਕ ਅੱਜ ਕੱਲ੍ਹ ਇਸ ਦਾ ਰੂਪ ਬਦਲ ਚੁੱਕਿਆ ਹੈ ਇਹ ਲੋਕ ਨਾਚ ਜਿਹੜਾ ਹੈ ਉਹ ਹਰ ਵਰਗ ਹਰ ਉਮਰ ਲੜਕੇ ਲੜਕੀਆਂ ਸਭ ਵੱਲੋਂ ਹੀ ਭੰਗੜੇ ਨੂੰ ਪਾਉਣਾ ਆਪਣੀ ਖੁਸ਼ੀ ਦੇ ਪ੍ਰਗਟਾਵੇ ਲਈ ਕੀਤਾ ਜਾਂਦਾ ਹੈ ਪਰ ਭੰਗੜਾ ਢੋਲਕ ਦੀ ਥਾਪ ਉੱਤੇ ਕਿਸੇ ਸਮੇਂ ਦੇ ਵਿੱਚ ਕਣਕ ਪੱਕਣ ਦੀ ਖੁਸ਼ੀ ਵਿੱਚ ਜਦੋਂ ਗੱਭਰੂ ਮੇਲਿਆਂ ਤੋਂ ਮੁੜਦਾ ਸੀ ਛਿੰਝਾਂ ਘੋਲਾਂ ਤੋਂ ਮੁੜਦਾ ਸੀ ਤਾਂ ਢੋਲ ਦੀ ਥਾਪ 'ਤੇ ਨੱਚਦਾ ਸੀ ਭੰਗੜਾ ਪੰਜਾਬੀਆਂ ਦੇ ਜਰਮਾਣੇ ਹੋਣ ਦਾ ਪ੍ਰਤੀਕ ਹੈ ਉਹਨਾਂ ਦੇ ਜੂਸੇ ਨੂੰ ਪ੍ਰਗਟ ਕਰਦਾ ਹੈ ਕਿਉਂਕਿ ਇਹ ਨਾਚ ਬਹੁਤ ਸਾਰੇ ਨਾਚਾਂ ਦਾ ਸੁਮੇਲ ਹੈ ਇਸ ਵਿੱਚ ਲੂਡੋ ਝੂੰਮਰ ਭਮੀਰੀਆਂ ਬਹੁਤ ਸਾਰੇ ਨਿੱਕੇ ਨਿੱਕੇ ਨੋਕ ਲੋਕ ਨਾਚ ਜਿਹੜੇ ਨੇ ਸ਼ਾਮਿਲ ਹਨ ਲੋਕ ਬੋਲੀਆਂ ਦੁਆਰਾ ਇਹ ਨਾਚ ਨੂੰ ਨੱਚਿਆ ਜਾਂਦਾ ਹੈ ਬੇਸ਼ੱਕ ਅੱਜ ਕੱਲ੍ਹ ਇਸਨੂੰ ਡੈਕ 'ਤੇ ਲਾ ਕੇ ਅਸੀਂ ਪੰਜਾਬੀ ਗੀਤਾਂ ਉੱਤੇ ਵੀ ਭੰਗੜਾ ਪਾ ਲੈਂਦੇ ਹਾਂ ਪਰ ਅਸਲ ਵਿੱਚ ਭੰਗੜਾ ਬਹੁਤ ਸਾਰੇ ਨਾਚਾਂ ਦਾ ਸੁਮੇਲ ਹੈ ਇਸ ਵਿੱਚ ਬੱਕਰੇ ਬੁਲਾਉਣਾ ਬੱਲੇ ਸ਼ਾਵਾ ਆਦਿ ਬਹੁਤ ਸਾਰੀਆਂ ਆਵਾਜ਼ਾਂ ਜਿਹੜੀਆਂ ਹਨ ਕੱਢੀਆਂ ਜਾਂਦੀਆਂ ਹਨ ਜਦੋਂ ਵੀ ਮਨ ਖੁਸ਼ੀ ਦੇ ਵਿੱਚ ਉਲਾਰਦਾ ਹੈ ਤਾਂ ਮਨੁੱਖ ਜੋ ਹਰਕਤ ਕਰਦਾ ਹੈ ਉਸਨੂੰ ਨਾਚ ਆਖਦੇ ਹਨ ਤਾਂ ਪੰਜਾਬੀ ਗੱਭਰੂ ਜਦੋਂ ਆਪਣੇ ਜੂਸੇ ਦਾ ਆਪਣੀ ਤਾਕਤ ਦਾ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਾ ਸੀ ਤਾਂ ਭੰਗੜੇ ਦਾ ਰੂਪ ਲੈ ਲੈਂਦਾ ਸੀ ਫਿਰ ਉਹ ਚਾਹੇ ਸੰਮਾਂ ਵਾਲੀ ਡਾਂਗ ਚੱਕ ਕੇ ਨੱਚਦਾ ਚਾਹੇ ਉਸਦੇ ਹੱਥ ਵਿੱਚ ਕਾਟੋ ਹੁੰਦੀ ਚਾਹੇ ਉਹ ਨਗੋਜਿਆਂ ਨਾਲ ਨੱਚਦਾ ਅਤੇ ਚਾਹੇ ਉਹ ਕਿਸੇ ਵੀ ਤਰ੍ਹਾਂ ਦੇ ਤਰੀਕੇ ਨਾਲ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਾ ਅਤੇ ਉਸਨੂੰ ਭੰਗੜੇ ਦੇ ਨਾਚ ਵਿੱਚ ਸ਼ਾਮਿਲ ਕੀਤਾ ਜਾਂਦਾ ਸੀ ਸੋ ਪੰਜਾਬੀ ਸੱਭਿਆਚਾਰ ਦਾ ਭੰਗੜਾ ਇੱਕ ਅਨਿਖੜ ਅੰਗ ਅਸੀਂ ਆਖ ਸਕਦੇ ਹਾਂ